ਮੈਂ ਬਹੁਤ ਚਿਰ ਤੋਂ ਆਪਣੇ ਬਾਲਾਂ ਲਈ ਕੁਛ ਖਰੀਦਣ ਦੀ ਸੋਚ ਰਿਹਾ ਸੀਗਾ ਤਾਂ ਹੀ ਮੈਂ ਆਪਣੀ ਫਲਿੱਪਕਾਰਟ ਤੋਂ ਦੇਖਿਆ ਕਿ ਇੱਕ ਪ੍ਰੋਡਕਟ ਸੀਗਾ ਬਾਲਾਂ ਦਾ ਜੋ ਕੰਡੀਸ਼ਨਰ ਨਾਮ 'ਤੇ ਸੀਗਾ ਅਤੇ ਉਸ 'ਤੇ ਕਾਫ਼ੀ ਔਫ ਚੱਲ ਰਿਹਾ ਸੀਗਾ ਅਤੇ ਉਹ ਕਾਫ਼ੀ ਨਵਾਂ ਸੀਗਾ ਤਾਂ ਮੈਂ ਸੋਚਿਆ ਕਿ ਮੈਂ ਉਹ ਖਰੀਦ ਲਵਾਂ ਜਿਸ ਨਾਲ਼ ਮੇਰੇ ਬਾਲਾਂ ਦੀ ਮਜ਼ਬੂਤੀ ਵੀ ਬਣੇਗੀ ਅਤੇ ਅੱਗੇ ਹੋਰ ਮੇਰੀ ਬਾਲ ਜਿਹੜੇ ਝੜ ਰਹੇ ਸੀ ਉਹ ਵੀ ਘੱਟ ਜਾਣਗੇ ਪਹਿਲਾਂ ਮੈਂ ਕਾਫ਼ੀ ਚਿਰ ਸੋਚਦਾ ਰਿਹਾ ਕਿ ਮੈਂ ਇਹ ਲਵਾਂ ਕਿ ਨਾ ਲਵਾਂ ਕਿ ਇਹ ਨਵੀਂ ਕੰਪਨੀ ਹੈ ਕਿ ਵਧੀਆ ਵੀ ਹੋਵੇਗੀ ਕਿ ਨਹੀਂ ਹੋਵੇਗੀ ਬਟ ਉੱਥੇ ਇੱਕ ਦੋ ਦੇ ਜਦੋਂ ਮੈਂ ਰਿਵਿਊਜ਼ ਪੜ੍ਹੇ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਇਹ ਕਾਫ਼ੀ ਅੱਛਾ ਪ੍ਰੋਡਕਟ ਹੈ ਤਾਂ ਫਿਰ ਮੈਂ ਸੋਚਿਆ ਕਿ ਮੈਂ ਖਰੀਦ ਹੀ ਲੈਂਦਾ ਹਾਂ ਤਾਂ ਫਿਰ ਮੈਂ ਜਦੋਂ ਖਰੀਦਿਆ ਅਤੇ ਵਰਤੋਂ ਵਿੱਚ ਲੈ ਕੇ ਆਇਆ ਮੇਰੇ ਬਾਲਾਂ ਦੇ ਮਜ਼ਬੂਤੀ ਨਾਲੋਂ ਮਜ਼ਬੂਤੀ ਪਹਿਲਾਂ ਨਾਲੋਂ ਹੋਰ ਘੱਟ ਚੁੱਕੀ ਅਤੇ ਬਾਲ ਮੇਰੇ ਹੋਰ ਝੜਨ ਲੱਗ ਗਏ ਪਹਿਲਾਂ ਮੈਨੂੰ ਸੀਗਾ ਕਿ ਇਹ ਨਵਾਂ ਨਵਾਂ ਨਵੀਂ ਨਵੀਂ ਚੀਜ਼ ਵਰਤੋਂ ਵਿੱਚ ਮੈਂ ਲਿਆ ਰਿਹਾ ਹੈ ਕਿ ਇਹ ਹਲੇ ਹੋਣਗੀ ਬਟ ਜਦੋਂ ਜਦੋਂ ਮੈਂ ਹਰ ਵਾਰ ਯੂਜ਼ ਕਰਦਾ ਤਾਂ ਮੇਰੇ ਬਾਲ ਹੋਰ ਜ਼ਿਆਦਾ ਝੜਨ ਲੱਗ ਗਏ ਸੀ ਜਿਸ ਕਰਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਅਤੇ ਮੈਂ ਇਸ ਦੀ ਕੰਪਲੇਂਟ ਫਲਿੱਪਕਾਰਟ ਜਾ ਕੇ ਵੀ ਕੀਤੀ ਕਿ ਇਹ ਜੋ ਪ੍ਰੋਡਕਟ ਹੈ ਕਿ ਹੋਰ ਅਗਰ ਯੂਜ਼ ਕਰੇ ਵਰਤੋਂ ਵਿੱਚ ਲੈ ਕੇ ਆਵੇਗਾ ਤਾਂ ਉਹਦੇ ਨਾਲ਼ ਵੀ ਜੋ ਮੇਰੇ ਨਾਲ਼ ਹੋਇਆ ਉਹ ਉਹ ਚੀਜ਼ ਉਹਨਾਂ ਨਾਲ਼ ਨਾ ਹੋਵੇ